ਪੰਜਾਬੀ ਭਾਸ਼ਾ ਜਿਹੜੀ ਆ ਇਸ ਖੇਤਰ ਦੇ ਵਿੱਚ ਜ਼ਿਆਦਾ ਬੋਲੀ ਜਾਂਦੀ ਆ ਅਤੇ ਇਹਨਾਂ ਖੇਤਰਾਂ ਦੇ ਵਿੱਚ ਹੀ ਬੋਡੋ ਬੰਗਾਲੀ ਜਿਹੜੇ ਆ ਲੋਕ ਆ ਕੇ ਮ ਕੰਮ ਕਰਦੇ ਹਨ ਅਤੇ ਉਹ ਆਪਣੀ ਭਾਸ਼ਾ ਨੂੰ ਬੋਲਦੇ ਹਨ ਅਤੇ ਉਹ ਪੰਜਾਬੀਆਂ ਨੂੰ ਤਾਂ ਸਮਝ ਨਹੀਂ ਲੱਗਦੀ ਪਰ ਉਹਨਾਂ ਨੂੰ ਸਾਡੀ ਪੰਜਾਬੀ ਭਾਸ਼ਾ 'ਚ ਸਮਝ ਲੱਗਦੀ ਹੈ ਜਿੱਦਾਂ ਬੋਡੋ ਇਲਾਕਾ ਨੇਪਾਲ ਦੇ ਵਿੱਚ ਬੰਗਲਾਦੇਸ਼ 'ਚ ਉੱਤਰ ਪੂਰਵ ਦੇ ਵਿੱਚ ਬੋਲੀ ਜਾਂਦੀ ਆ ਅਤੇ ਜਿਹੜੀ ਬੰਗਾਲੀ ਉਹ ਕਲਕੱਤੇ ਵਾਲੀ ਸਾਈਡ ਤੋਂ ਵੀ ਬੰਗਾਲ ਤੋਂ ਜ਼ਿਆਦਾ ਬੋਲੀ ਇਹ ਲੋਕ ਸਾਡੇ ਆ ਕੇ ਕੰਮ ਕਰਦੇ ਹਨ ਅਤੇ ਸਾਡੇ ਨਾਲ ਹੀ ਰਹਿੰਦੇ ਹਨ ਅਤੇ ਅਸੀਂ ਥੋੜ੍ਹੀ ਥੋੜ੍ਹੀ ਭਾਸ਼ਾ ਇਹਨਾਂ ਦੀ ਜਿਹੜੀ ਬੋਲਦੇ ਹਾਂ ਸਮਝਣ ਲੱਗ ਪਏ ਹਾਂ